ਸਾਡੇ ਲਾ ਨੀਅਰਬਾਏ ਇੱਕ ਟੀ ਡੀ ਆਈ ਸਿਟੀ ਹੈ ਜਿੱਥੇ ਸਾਰੀ ਦੁਨੀਆ ਸ਼ਾਮ ਨੂੰ ਇਕੱਠੀ ਹੋ ਕੇ ਸੈਰ ਸਪਾਟਾ ਕਰਦੀ ਹੈ ਵੋਕ ਕਰਦੀ ਹੈ ਭੱਜਦੀ ਹੈ ਖੇਡਦੀ ਆ ਬੱਚੇ ਇਕੱਠੇ ਹੋ ਕੇ ਪਾਰਕ 'ਚ ਝੂਟੇ ਝਾਟੇ ਲੈਣ ਆਉਂਦੇ ਆ ਅਤੇ ਜਦੋਂ ਸਾਡੇ ਮਹਿਮਾਨ ਆਉਂਦੇ ਹਨ ਉਹ ਵੀ ਸ਼ਾਮ ਨੂੰ ਆ ਕੇ ਕਹਿੰਦੇ ਹਨ ਕਿ ਚਲੋ ਸਾਨੂੰ ਕਿਤੇ ਘੁੰਮਾ ਕੇ ਲਿਆਓ ਤਾਂ ਅਸੀਂ ਉਹ ਪਾਰਕ ਵਿੱਚ ਉਹਨਾਂ ਨੂੰ ਲੈ ਜਾਂਦੇ ਹਾਂ ਅਤੇ ਉਹ ਵੀ ਉੱਥੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਉੱਥੇ ਛੋਟੇ ਬੱਚੇ ਬਹੁਤ ਹੀ ਜ਼ਿਆਦਾ ਚੰਗ ਚੰਗੇ ਤਰੀਕੇ ਨਾਲ਼ ਖੇਡਦੇ ਹਨ ਅਤੇ ਉੱਥੇ ਜਾ ਕੇ ਸਾਰੇ ਘੁਲ ਮਿਲ ਜਾਂਦੇ ਹਨ ਉੱਥੇ ਬਹੁਤ ਹੀ ਚੰਗਾ ਇਨਵਾਇਰਮੈਂਟ ਆ ਅਤੇ ਸਾਨੂੰ ਬਹੁਤ ਹੀ ਸਾਫ਼ ਸੁਥਰੀ ਉੱਥੇ ਹਵਾ ਵੀ ਮਿਲਦੀ ਆ ਅਤੇ ਸਾਡੇ ਰਿਸ਼ਤੇਦਾਰ ਉੱਥੇ ਜਾ ਕੇ ਬੜੇ ਹੀ ਖੁਸ਼ ਹੁੰਦੇ ਹਨ